ਇੱਥੇ ਲੋਕ ਮੱਕੀ ਚਾਵਲ ਕਪਾਹ ਹਲਦੀ ਕਣਕ ਦਾਲਾਂ ਜਿਵੇਂ ਮੂੰਗੀ ਮਾਂਹ ਮਸਰ ਮੋਠ ਜਾਂ ਬਾਜਰਾ ਜਵਾਰ ਗੰਨਾ ਸਰੋਂ ਫਿਰ ਜਿਸ ਤਰ੍ਹਾਂ ਸਬਜ਼ੀਆਂ ਹੈਗੀਆਂ ਨੇ ਸਾਗ ਪਾਲਕ ਘੀਆ ਕੱਦੂ ਹਲਵਾ ਬੈ ਬੈਂਗਣ ਹੋਰ ਫਲੀਆਂ ਆਦਿ ਜਿਸ ਤਰ੍ਹਾਂ ਦੀ ਖੇਤੀ ਕਰਦੇ ਨੇ ਅਤੇ ਫਲਾਂ ਦੇ ਵਿੱਚ ਅੰਬ ਪਪੀਤਾ ਸੇਬ ਅੰਗੂਰ ਕੇਲਾ ਦੀ ਫ ਫਸਲ ਵੀ ਇੱਥੇ ਬੀਜੀ ਜਾਂਦੀ ਹੈ ਪਸ਼ੂ ਜਿਹੜੇ ਨੇ ਖੇਤੀ ਦੇ ਕੰਮ ਆਉਂਦੇ ਨੇ ਜਿਵੇਂ ਘੋੜਾ ਗਾਂ ਮੱਝ ਬੱਕਰੀ ਗਧਾ ਭਾਰ ਚੁੱਕਣ ਦੇ ਕੰਮ ਆਉਂਦਾ ਬਲਦ ਖੇਤੀ ਦੇ ਕੰਮ ਆਉਂਦਾ ਖਰਗੋਸ਼ ਲੋਕਾਂ ਨੇ ਆਪਣੇ ਘਰਾਂ ਵਿੱਚ ਸਾਵਧਾਨੀ ਵਾਸਤੇ ਕੁੱਤੇ ਰੱਖੇ ਹੁੰਦੇ ਨੇ ਬਾਂਦਰ ਹਾਥੀ ਮੋਰ ਹਿਰਨ ਆਦਿ ਪਾਲੇ ਹੋਏ ਹਨ